ਸਾਡੇ ਆਲੇ ਦੁਆਲੇ ਬਹੁਤ ਛੋਟੇ ਵੱਡੇ ਡਾਂਸ ਗਰੁੱਪ ਜਾਂ ਅਕੈਡਮੀਆਂ ਹਨ ਜਿਹਨਾਂ ਨੇ ਡਾਂਸ ਪ੍ਰਦਰਸ਼ਨਾਂ ਦੀ ਗੁਣਵੱਤਾ ਨੂੰ ਸੁਧਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਇਹਨਾਂ ਵਿੱਚੋਂ ਅਜੈ ਡਾਂਸ ਅਕੈਡਮੀ ਵਾਈਬ ਡਾਂਸ ਸਕੂਲ ਕਾਲਾਨੀਧੀ ਡਾਂਸ ਗਰੁੱਪ ਰੋਇਲ ਫੈਮਲੀ ਡਾਂਸ ਗਰੁੱਪ ਦੇਸੀ ਹੂਪਰ ਡਾਂਸ ਗਰੁੱਪ ਆਦਿ ਸ਼ਾਮਿਲ ਹਨ ਕਿਉਂਕਿ ਇਹਨਾਂ ਡਾਂਸ ਗਰੁੱਪਾਂ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਡਾਂਸ ਸਿਖਾਇਆ ਜਾਂਦਾ ਹਰ ਉਮਰ ਦੇ ਬੱਚੇ ਔਰਤਾਂ ਅਤੇ ਨੌਜਵਾਨ ਇਹਨਾਂ ਗਰੁੱਪਾਂ ਵਿੱਚ ਭਾਗ ਲੈਂਦੇ ਹਨ ਅਤੇ ਡਾਂਸ ਦੇ ਤਜਰਬੇਕਾਰ ਮਾਹਰਾਂ ਕੋਲੋਂ ਡਾਂਸ ਦੀ ਸਿੱਖਿਆ ਲੈਂਦੇ ਹਨ ਮੈਂ ਹੋਰ ਲੋਕਾਂ ਨੂੰ ਡਾਂਸ ਕਰਨ ਲਈ ਡਾਂਸ ਦੇ ਲਾਭ ਦੱਸਦਾ ਹਾਂ ਕਿਉਂਕਿ ਡਾਂਸ ਇੱਕ ਮਨੋਰੰਜਨ ਦਾ ਸਾਧਨ ਹੈ ਇਸ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਕਿਉਂਕਿ ਇਸ ਨਾਲ ਸਾਡੇ ਸਰੀਰ ਨੂੰ ਸਰੀਰਕ ਅਤੇ ਮਨ ਨੂੰ ਮਾਨਸਿਕ ਸ਼ਕਤੀ ਮਿਲਦੀ ਹੈ ਮੈਂ ਨੌਜਵਾਨਾਂ ਨੂੰ ਦੱਸਦਾ ਹਾਂ ਕਿ ਤੁਸੀਂ ਡਾਂਸ ਸਿੱਖ ਕੇ ਸਟੇਜਾਂ 'ਤੇ ਡਾਂਸ ਪ੍ਰੋਗਰਾਮਾਂ ਵਿੱਚ ਭਾਗ ਲੈ ਸਕਦੇ ਹੋ ਇਸ ਤੋਂ ਬਿਨਾਂ ਡਾਂਸ ਸਿੱਖਣ ਨਾਲ ਕਈਆਂ ਨੂੰ ਰੁਜ਼ਗਾਰ ਦੇ ਮੌਕੇ ਵੀ ਮਿਲਦੇ ਹਨ ਜਿਵੇਂ ਉਹ ਫਿਲਮਾਂ ਗੀਤਾਂ ਦੀਆਂ ਵੀਡੀਓ ਵਿੱਚ ਵੀ ਭਾਗ ਲੈ ਸਕਦੇ ਹਨ ਅਤੇ ਉਹ ਆਪਣੇ ਡਾਂਸ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਰਾਸ਼ਟਰੀ ਪੱਧਰ ਤੋਂ ਅੰਤਰਰਾਸ਼ਟਰੀ ਮੰਚ ਤੱਕ ਪਹੁੰਚ ਸਕਦੇ ਹਨ ਅਸੀਂ ਕਈ ਫਿਲਮੀ ਕਲਾਕਾਰਾਂ ਦੀ ਵੀ ਉਦਾਹਰਨ ਲੈ ਸਕਦੇ ਹਾਂ ਜਿਵੇਂ ਮੈਂ ਗੱਲ ਕਰਾਂ ਪ੍ਰਭੂ ਦੇਵੇ ਦੀ ਉਹ ਇੱਕ ਸਧਾਰਨ ਡਾਂਸ ਤੋਂ ਸਿੱਖ ਕੇ ਵਧੀਆ ਡਾਂਸਰ ਬਣ ਕੇ ਉਹ ਬਹੁਤ ਉੱਚੇ ਮੁਕਾਮ 'ਤੇ ਪਹੁੰਚਿਆ ਹੈ ਨੌਜਵਾਨ ਉਹਨਾਂ ਤੋਂ ਵੀ ਬਹੁਤ ਕੁਛ ਸਿੱਖ ਸਕਦੇ ਹਨ